ਅਸੀਂ ਜੇ ਦੇਖਦੇ ਹਾਂ ਕਿ ਸਾਡੇ ਪੰਜਾਬੀ ਭਾਸ਼ਾ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦੇ ਆਏ ਹਨ ਸਭ ਤੋਂ ਪਹਿਲਾਂ ਭਾਸ਼ਾ ਕੁਛ ਹੋਰ ਤਰ੍ਹਾਂ ਦੀ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਹੋਰ ਇਸਦੇ ਅੰਦਰ ਇਤਿਹਾਸ ਸੱਭਿਆਚਾਰ ਜੁੜਦੇ ਗਏ ਪੰਜਾਬੀ ਭਾਸ਼ਾ ਵਿੱਚ ਪਰਿਵਰਤਨ ਆਉਂਦਾ ਗਿਆ ਹੌਲੀ ਹੌਲੀ ਪੰਜਾਬੀ ਭਾਸ਼ਾ ਕਿਸੇ ਇਲਾਕੇ ਵਿੱਚ ਉੱਭਰਦੀ ਗਈ ਕਿਸੇ ਇਲਾਕੇ ਵਿੱਚ ਪੰਜਾਬੀ ਭਾਸ਼ਾ ਦੀ ਜਗ੍ਹਾ ਹੋਰ ਭਾਸ਼ਾਵਾਂ ਥਾਂ ਲੈਣ ਲੱਗ ਪਈਆਂ ਜਿਵੇਂ ਕਿ ਅਸੀਂ ਦੇਖੀਏ ਕਿ ਸਭ ਤੋਂ ਪਹਿਲਾਂ ਜਦ ਪੰਜਾਬ ਵਿੱਚ ਕਹਿ ਲਈਏ ਪੰਜਾਬੀ ਬੋਲੀ ਜਾਂਦੀ ਹੈ ਪੰਜਾਬ ਵਿੱਚ ਹੋਰ ਸਟੇਟ ਦੇ ਵਸਨੀਕ ਆ ਕੇ ਰਹਿਣ ਲੱਗਦੇ ਹਨ ਤਾਂ ਉਨ੍ਹਾਂ ਦੇ ਇਤਿਹਾਸ ਦਾ ਸਾਡੇ ਸੱਭਿਆਚਾਰ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਸੱਭਿਆਚਾਰ ਦੇ ਨਾਲ਼ ਹੀ ਸਾਡੀ ਭਾਸ਼ਾ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਵੇਂ ਅਸੀਂ ਉਹਨਾਂ ਨਾਲ ਮਿਲਦੇ ਜੁਲਦੇ ਜੁਲਦੇ ਹਾਂ ਵਰਤਦੇ ਹਾਂ ਉਹਨਾਂ ਨਾਲ ਬਹਿੰਦੇ ਉੱਠਦੇ ਹਾਂ ਅਸੀਂ ਉਹਨਾਂ ਦੀ ਭਾਸ਼ਾ ਨੂੰ ਥੋੜ੍ਹਾ ਥੋੜ੍ਹਾ ਗ੍ਰਹਿਣ ਕਰਦੇ ਜਾਂਦੇ ਹਨ ਜਿਸ ਨਾਲ ਕਿ ਸਾਡੀ ਭਾਸ਼ਾ ਅਤੇ ਉਹਨਾਂ ਦੀ ਭਾਸ਼ਾ ਇਕੱਠੀਆਂ ਹੋ ਕੇ ਇੱਕ ਅਲੱਗ ਭਾਸ਼ਾ ਦਾ ਰੂਪ ਲੈ ਲੈਂਦੀਆਂ ਹਨ ਜਾਂ ਕਹਿ ਸਕਦੇ ਹਨ ਕਿ ਸਾਡੀ ਭਾਸ਼ਾ ਵਿੱਚ ਪਰਿਵਰਤਨ ਆਉਣ ਲੱਗ ਜਾਂਦਾ ਹੈ ਜਿਵੇਂ ਜਿਵੇਂ ਅਸੀਂ ਹੋਰ ਸਟੇਟ ਦੇ ਲੋਕਾਂ ਦੇ ਨਾਲ ਬਹਿੰਦੇ ਉੱਠਦੇ ਹਨ ਮਿਲਦੇ ਵਰਤਦੇ ਹਨ ਉਹਨਾਂ ਦੀ ਸੱਭਿਆਚਾਰ ਨੂੰ ਹੌਲੀ ਹੌਲੀ ਗ੍ਰਹਿਣ ਕਰਦੇ ਜਾਂਦੇ ਹਾਂ ਉਸਦੇ ਨਾਲ ਸਾਡੀ ਭਾਸ਼ਾ ਵੀ ਅਲੱਗ ਤੋਂ ਰੂਪ ਲੈਂਦੀ ਜਾ ਰਹੀ ਹੈ ਪੰਜਾਬੀ ਭਾਸ਼ਾ ਪਹਿਲਾਂ ਕੁਛ ਹੋਰ ਸੀ ਅਤੇ ਹੁਣ ਦੇਖਦੇ ਹਾਂ ਹੋਰ ਬਣ ਚੁੱਕੀ ਹੈ ਅਲੱਗ ਤੋਂ ਅਲੱਗ ਇਹਦੇ ਵਿੱਚ ਸ਼ਬਦ ਜੁੜਦੇ ਜਾ ਰਹੇ ਹਨ ਜਾਂ ਕਹਿ ਸਕਦੇ ਹਾਂ ਕਿ ਕੱਪੜਾ ਆਪਾਂ ਕਿਸੇ ਦੇ ਕੱਪੜਿਆਂ ਵੱਲ ਦੇਖੀਏ ਪਹਿਰਾਵਾ ਦੇਖਦੇ ਹਾਂ ਪਹਿਲਾਂ ਪਹਿਰਾਵਾ ਸਿੰਪਲ ਸਾਦਾ ਸੀ ਹੁਣ ਜਿਵੇਂ ਜਿਵੇਂ ਹੋਰ ਸਟੇਟਾਂ ਦੇ ਆਏ ਲੋਕ ਰਹਿਣ ਲੱਗੇ ਅਸੀਂ ਉਹਨਾਂ ਦੇ ਪਹਿਰਾਵੇ ਗ੍ਰਹਿਣ ਕਰਨ ਲੱਗੇ ਉਹਨਾਂ ਦੀ ਦੇਖਦੇ ਦੇਖਦੇ ਕੁੜਤੇ ਪਜਾਮੇ ਪਾਉਣ ਲੱਗੇ ਕੋਈ ਕੁੜਤੇ ਪਜਾਮਿਆਂ ਵਾਲੇ ਕੋਟ ਪੈਂਟ ਵਿੱਚ ਆਉਣ ਲੱਗੇ ਇਸ ਤਰ੍ਹਾਂ ਸਾਡਾ ਪਹਿਰਾਵਾ ਚੇਂਜ ਹੁੰਦਾ ਗਿਆ ਪਹਿਰਾਵੇ ਦੇ ਨਾਲ ਨਾਲ ਭਾਸ਼ਾ ਤਾਂ ਬਿਲਕੁਲ ਬਣਦਾ ਹੀ ਹੈ ਕਿ ਚੇਂਜ ਹੁੰਦੀ ਗਈ ਬਦਲਦੀ ਗਈ ਭਾਸ਼ਾ ਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਜੇ ਦੇਖੀਏ ਦਸਾਂ ਸਾਲਾਂ ਦੇ ਵਿੱਚ ਵਿੱਚ ਭਾਸ਼ਾ ਐਨੀ ਬਦਲਦੀ ਗਈ ਕਿ ਹੁਣ ਇਸਦੇ ਵਿੱਚ ਪੰਦਰਾਂ ਤੋਂ ਸੋਲ੍ਹਾਂ ਭਾਸ਼ਾਵਾਂ ਆ ਕੇ ਮਿਲ ਚੁੱਕੀਆਂ ਜੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਪਹਿਲਾਂ ਦੇਖਿਆ ਜਾਂਦਾ ਸੀ ਪੰਜਾਬੀ ਵਿੱਚ ਜਾਂ ਸ਼ੁੱਧ ਪੰਜਾਬੀ ਵਿੱਚ ਹੀ ਗੱਲ ਕੀਤੀ ਜਾਂਦੀ ਸੀ ਹੁਣ ਜਦੋਂ ਗੱਲ ਕਰਦੇ ਹਾਂ ਆਪਾਂ ਇੱਕ ਦੋ ਬੰਦਿਆਂ ਨੂੰ ਦੇਖਦੇ ਹਨ ਕੀ ਗੱਲ ਕਰਦੇ ਹਨ ਤਾਂ ਉਹ ਤਿੰਨ ਤੋਂ ਚਾਰ ਭਾਸ਼ਾਵਾਂ ਦੇ ਵਿੱਚ ਗੱਲ ਕਰਦੇ ਜਿਵੇਂ ਕੁਝ ਸ਼ਬਦ ਪੰਜਾਬੀ ਦੇ ਬੋਲਦੇ ਹਨ ਵਿੱਚ ਕੁਝ ਹਿੰਦੀ ਦੇ ਬੋਲ ਦਿੰਦੇ ਹਨ ਅਤੇ ਨਾਲ ਹੀ ਕੁਛ ਇੰਗਲਿਸ਼ ਦੇ ਬੋਲ ਦਿੰਦੇ ਹਨ ਇਹ ਦੇਖ ਇਹ ਦੇਖ ਕੇ ਅਸੀਂ ਕਹਿ ਸਕਦੇ ਹਨ ਕਿ ਸਾਡੀ ਭਾਸ਼ਾ 'ਤੇ ਬਹੁਤ ਪ੍ਰਭਾਵ ਪਿਆ ਹੋਰ ਭਾਸ਼ਾਵਾਂ ਦਾ ਹੋਰ ਭਾਸ਼ਾਵਾਂ ਆ ਕੇ ਮਿਕਸ ਹੋਈਆਂ